ਹੈਲੋ

ਹਾਂਜੀ ਹਾਂਜੀ ਅੱਛਾ ਸ਼੍ਰੀ ਅਨੰਦਪੁਰ ਸਾਹਿਬ ਮੇਲਾ ਲੱਗਦਾ ਹਾਂਜੀ ਉਸ ਦਿਨ ਉੱਥੇ ਹੋਲੀ ਤੋਂ ਇੱਕ ਦਿਨ ਪਹਿਲਾਂ ਲੱਗਦਾ ਵਾ ਇਹ ਉੱਥੇ ਵਾਹਵਾ ਲੋਕ ਸ਼ਰਧਾ ਭਾਵ ਨਾਲ ਜਾਂਦੇ ਹੈ ਮਤਲਬ ਵਾਹਵਾ ਹੋਲੀ ਬਹੁਤ ਲੰਗਰ ਲੱਗਦਾ ਬਹੁਤ ਵਧੀਆ ਤਰੀਕੇ ਨਾਲ ਮਨਾਉਂਦੇ ਆ ਸਿੱਖ ਇਹਨੂੰ ਤੁਸੀਂ ਦੱਸੋ ਵੀ ਹਾਂਜੀ ਹਾਂਜੀ ਤੁਸੀਂ ਇੱਕ ਹਫਤੇ ਤੱਕ ਹੁੰਦਾ ਉੱਥੇ ਹੁੰਦੇ ਹੈ ਹੋਟਲ ਵਗੈਰਾ ਤੁਸੀਂ ਉੱਥੇ ਜਾ ਸਕਦੇ ਹੋ ਉੱਥੇ ਹਾਂਜੀ ਹਾਂਜੀ ਲੰਗਰ ਦੀ ਵੀ ਉੱਥੇ ਸੁਵਿਧਾ ਹੁੰਦੀ ਹੈ ਚੋ ਚੌਵੀ ਘੰਟੇ ਲੱਗਦਾ ਹੈਗਾ ਉੱਥੇ ਅਤੇ ਤੁਸੀਂ ਉੱਥੇ ਲੰਗਰ ਛਕ ਸਕਦੇ ਹੈਗੇ ਹੋ ਅਤੇ ਹੋਰ ਵੀ ਉੱਥੇ ਤੁਸੀਂ ਘੁੰਮਣ ਵਾਲੀ ਥਾਵਾਂ 'ਤੇ ਘੁੰਮ ਸਕਦੇ ਹੋ ਤੁਸੀਂ ਹਾਂਜੀ ਹਾਂਜੀ ਤੁਸੀਂ ਏਟ ਥਾਊਂਸੈਡ ਅੱਠ ਹਜ਼ਾਰ ਤੱਕ ਲੈ ਕੇ ਮੰਨ ਕੇ ਚੱਲੋ ਹਾਂਜੀ ਫੇਰ ਤੁਸੀਂ ਹਾਂਜੀ ਹਾਂਜੀ ਇਹ ਤਾਂ ਹੈ ਹਾਂਜੀ ਦਰਸ਼ਨ ਤਾਂ ਕਰਨੇ ਹਾਂਜੀ ਫੇਰ ਤੁਸੀਂ ਟੈਨ ਥਾਊਂਸੈਡ 'ਤੇ ਮੈਂ ਤੁਹਾਡੇ ਨਾਲ ਚੱਲ ਥਾਊਂਸੈਡ ਤੱਕ ਦੇ ਸਕਦੇ ਹੋ ਮੈਨੂੰ ਹਾਂਜੀ ਹਾਂਜੀ ਮੈਂ ਚੌਵੀ ਘੰਟੇ ਤੁਹਾਡੇ ਨਾਲ ਹੀ ਰਹਾਂਗਾ ਹਾਂਜੀ ਹਾਂਜੀ ਜ਼ਰੂਰ ਵੀਰੇ ਹਾਂਜੀ ਬਾਏ